ਪੰਜਾਬ ਵਿੱਚ ਸੰਗੀਤ ਅਤੇ ਨ੍ਰਿੱਤ ਤਿਉਹਾਰ ਇਸ ਪ੍ਰਕਾਰ ਹਨ ਜਿਵੇਂ ਕਿ ਲੋਹੜੀ ਦਾ ਤਿਉਹਾਰ ਇਸ ਤਿਉਹਾਰ ਸਮੇਂ ਅੱਗ ਬਾਲ ਕੇ ਦੁੱਲਾ ਭੱਟੀ ਦਾ ਗੀਤ ਗਾਇਆ ਜਾਂਦਾ ਹੈ ਜੋ ਕਿ ਇੱਕ ਲੋਕ ਗੀਤ ਹੈ ਇਸੇ ਪ੍ਰਕਾਰ ਬਹੁਤ ਸਾਰੇ ਗੀਤ ਗਾਏ ਜਾਂਦੇ ਹਨ ਜਿਵੇਂ ਕਿ ਕੁੜੀਆਂ ਦੇ ਵਿਆਹ 'ਤੇ ਸੁਹਾਗ ਅਤੇ ਮੁੰਡਿਆਂ ਦੇ ਵਿਆਹ 'ਤੇ ਘੋੜੀਆਂ ਗਾਈਆਂ ਜਾਂਦੀਆਂ ਹਨ ਜੋ ਕਿ ਪੰਜਾਬ ਦੇ ਪ੍ਰਮੁੱਖ ਲੋਕ ਗੀਤ ਹਨ